ਹਾਂਜੀ ਅਸੀਂ ਬਿਜਲੀ ਦੇ ਖ਼ਤਰਿਆਂ ਤੋਂ ਬਹੁਤ ਜ਼ਿਆਦਾ ਜਾਣੂ ਹਾਂ ਕਿਉਂਕਿ ਅੱਜ ਕੱਲ੍ਹ ਦਾ ਸਮਾਂ ਜਿਹੜਾ ਇਹ ਬਿਜਲੀ ਦਾ ਹੀ ਦਾ ਯੁੱਗ ਹੈ ਕਿ ਸਾਨੂੰ ਜਿਸ ਤਰਾਂ ਘਰ ਦੇ ਵਿੱਚ ਰੋਟੀ ਚਾਹ ਪਾਣੀ ਦੀ ਜਰੂਰਤ ਇਸ ਤਰ੍ਹਾਂ ਅਸੀਂ ਬਿਜਲੀ ਤੋਂ ਬਗੈਰ ਇੱਕ ਮਿੰਟ ਵੀ ਨਹੀਂ ਰਹਿ ਸਕਦੇ ਕਿਉਂਕਿ ਫਰਿੱਜ ਕੂਲਰ ਟੀ ਵੀ ਐਲ ਸੀ ਡੀ ਪੱਖੇ ਸਾ ਹਰ ਇੱਕ ਚੀਜ਼ ਬਿਜਲੀ 'ਤੇ ਹੋ ਚੁੱਕੀ ਹੈ ਇਸ ਕਰਕੇ ਸਾਨੂੰ ਬਿਜਲੀ ਤੋਂ ਮਤਲਬ ਕਿ ਜਿੰਨੇ ਸਾਨੂੰ ਫਾਇਦੇ ਹੈ ਇਸ ਦੇ ਨੁਕਸਾਨ ਵੀ ਹੈ ਨੁਕਸਾਨ ਸਾਨੂੰ ਕੀ ਹੈ ਕਿ ਜਦੋਂ ਕਿਸੇ ਮਤਲਬ ਕਿ ਬਿਜਲੀ ਦੀ ਤਾਰ ਕੋਈ ਨੰਗੀ ਰਹਿ ਜੇ ਕਿਤੇ ਜੋੜ ਨੰਗਾ ਹੋਵੇ ਕਿਤੇ ਖਾ ਨੰਗੇ ਪੈਰੀਂ ਅਸੀਂ ਹੱਥ ਲਾ ਲੈਂਦੇ ਹਾਂ ਤੋ ਉਸ ਤੋਂ ਸਾਨੂੰ ਝਟਕਾ ਲੱਗ ਜਾਂਦਾ ਹੈਗਾ ਉਸ ਤੋਂ ਸਾਨੂੰ ਨੁਕਸਾਨ ਕਰਦੇ ਹਨ ਬਿਜਲੀ ਇੱਕ ਹਿੱਸਾ ਹੈ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਕਿ ਸਾਨੂੰ ਤਾਂ ਭਾਈ ਹਰ ਇੱਕ ਘਰ ਪਰਿਵਾਰ ਦੇ ਵਿੱਚ ਸਾਨੂੰ ਜਿਸ ਤਰ੍ਹਾਂ ਕਿ ਅਸੀਂ ਪਾਣੀ ਦੀ ਰੋਟੀ ਤੋਂ ਬਿਨਾਂ ਨਹੀਂ ਰਹਿੰਦੇ ਇਸ ਤਰ੍ਹਾਂ ਸਾਨੂੰ ਪਾਣੀ ਵਾਲੀ ਜਿਵੇਂ ਮੋਟਰ ਆ ਮੋਟਰ ਨੂੰ ਹਮੇਸ਼ਾ ਨੰਗੀ ਨਹੀਂ ਰੱਖਣਾ ਚਾਹੀਦਾ ਉਸ ਦੇ ਉੱਪਰ ਕਵਰ ਹੋਣਾ ਚਾਹੀਦਾ ਕਿਉਂਕਿ ਮੀਂਹ ਕਣੀ ਦੀ ਰੁੱਤ ਹੋਵੇ ਉਦੋਂ ਉਸ ਨੂੰ ਹੱ ਉਹਦੇ ਉੱਪਰ ਮਤਲਬ ਕਿ ਢੱਕਣਾ ਚਾਹੀਦਾ ਉਹਨੂੰ ਕਈ ਵਾਰੀ ਉਸ ਤੋਂ ਕਰੰਟ ਸ਼ਾਂਟ ਨੇੜੇ ਹੁੰਦਿਆਂ ਤੋਂ ਲੱਗ ਜਾਂਦਾ ਹੈਗਾ ਇਸ ਕਰਕੇ ਅਸੀਂ ਮਤਲਬ ਕਿ ਇਸ ਇਸ ਨੂੰ ਖ਼ਤਰੇ ਖਟੀ ਖ਼ਤਰੇ ਹੀ ਖ਼ਤਰੇ ਹੈ ਸਾਨੂੰ ਬਿਜਲੀ ਦੇ ਅਤੇ ਉਹ ਹੁਣ ਸਾਨੂੰ ਇਹ ਹੈਗਾ ਕਿ ਅਸੀਂ ਕਿਵੇਂ ਬਚਣਾ ਹੈਗਾ ਇਹਨਾਂ ਤੋਂ ਅਸੀਂ ਜਿੰਨੇ ਸਾਡੇ ਘਰ ਦੇ ਵਿੱਚ ਤਾਰਾਂ ਅਸੀਂ ਲਾਉਂਦੇ ਹਾਂ ਫਰਿੱਜ ਦੀ ਕੂਲਰ ਦੀ ਟੀ ਵੀ ਦੀ ਉਹਨਾਂ ਦੇ ਉੱਪਰ ਸ਼ੂ ਲੱਗੇ ਹੋਣੇ ਚਾਹੀਦੇ ਆ ਜਦੋਂ ਅਸੀਂ ਬਿਜਲੀ ਦਾ ਕੋਈ ਵੀ ਕੰਮ ਕਰਦੇ ਹਾਂ ਕੋਈ ਸੁੱਚ ਛੱਡਦੇ ਹਾਂ ਪੱਖਾ ਕੂਲਰ ਲਾਉਂਦੇ ਹਾਂ ਤਾਂ ਤਾਰਾਂ ਨੰਗੀਆਂ ਨਹੀਂ ਹੋਣੀਆਂ ਚਾਹੀਦੀਆਂ ਉਹਦੇ ਸ਼ੂ ਲੱਗੇ ਹੋਣੇ ਚਾਹੀਦੇ ਅਸੀਂ ਸ਼ੂ ਲਾਈਏ ਅਤੇ ਫਿਰ ਸੁੱਚ ਛੱਡੀਏ ਜੇਕਰ ਅਸੀਂ ਇਹ ਇੱਕ ਨਹੀਂ ਕਰਦੇ ਤਾਂ ਸਾਨੂੰ ਇਸ ਤੋਂ ਖ਼ਤਰੇ ਹੀ ਖ਼ਤਰਾ ਹੈ ਇਸ ਕਰਕੇ ਸਾਨੂੰ ਜਿਹੜੇ ਛੋਟੇ ਬੱਚੇ ਆ ਉਹ ਸਕੂਲ ਕਾਲਜ ਜਾਂਦੇ ਸਾਨੂੰ ਉਹਨਾਂ ਨੂੰ ਸਿਖਲਾਈ ਦੇਣੀ ਚਾਹੀਦੀ ਕਿ ਬੱਚੇ ਸਕੂਲ ਕਾਲਜ ਦੇ ਵਿੱਚ ਕਿਤੇ ਕੋਈ ਪੱਖਾ ਛੱਡਣਾ ਹੈ ਕਿਤੇ ਕੋਈ ਮੋਟਰ ਚੱਲਦੀ ਹੈ ਤਾਂ ਕੋਈ ਉਸ ਦੇ ਨੇੜੇ ਨਹੀਂ ਹੋਣਾ ਚਾਹੀਦਾ ਸਾਨੂੰ ਸਾਨੂੰ ਉਸ 'ਤੇ ਬਿਨਾਂ ਬੂਟ ਚੱਪਲ ਵਗੈਰਾ ਪਾਇਆ ਹੋਣਾ ਚਾਹੀਦਾ ਤਾਂ ਜੋ ਕਿ ਅਸੀਂ ਉਸ ਤੋਂ ਸੁਰੱਖਿਅਤ ਰਹਿ ਸਕੀਏ ਅਤੇ ਤਾਰਾਂ ਜ ਜਾਂ ਤਾਰਾਂ ਦੇ ਜਾਲ ਮਤਲਬ ਕਿ ਛੱਤ ਦੇ ਉੱਪਰ ਛੱਤ ਦੇ ਉੱਪਰ ਵੀ ਕਈ ਸਵਿਚ ਤਾਰਾਂ ਲਾ ਦਿੰਦੇ ਆ ਉਹ ਸਾਡੇ ਜੋੜ ਮਤਲਬ ਕਿ ਢਕੇ ਹੋਣੇ ਚਾਹੀਦੇ ਉਹ ਢਕੇ ਹੋਣੇ ਚਾਹੀਦੇ ਹੈਗੇ ਤਾਂ ਜੋ ਕਿ ਕੋਈ ਬੱਚਾ ਜਾਂ ਕੋਈ ਸਿਆਣਾ ਆਦਮੀ ਕੋਈ ਵੀ ਉਸ ਨੂੰ ਹੱਥ ਨਾ ਲਾ ਸਕੇ ਜੇਕਰ ਅਸੀਂ ਇਹ ਸਾਵਧਾਨੀਆਂ ਵਰਤਾਂਗੇ ਸਾਡਾ ਪੈਰ ਹੈ ਜਿਹੜਾ ਕਦੇ ਵੀ ਜੇ ਨੰਗੀ ਤਾਰ ਦਾ ਜੋੜ ਕਿਤੇ ਰਹਿ ਜਾਵੇ ਅਸੀਂ ਕਿਤੇ ਛੱਤ ਦੇ ਉੱਪਰ ਚੜਦੇ ਹਾਂ ਜਾਂ ਵਿਹੜੇ ਦੇ ਵਿੱਚ ਜਾਂ ਕੰਧ ਦੇ ਨਾਲ ਹੀ ਅਸੀਂ ਕਈ ਵਾਰੀ ਤਾਰ ਨਾਲ ਨਾਲ ਲਾ ਦਿੰਦੇ ਤਾਂ ਉਸ ਜਦੋਂ ਅਸੀਂ ਉੱਥੇ ਤੁਰਦੇ ਹਾਂ ਤਾਂ ਸਾਡਾ ਪੈਰ ਟਿਕ ਜਾਂਦਾ ਉਹਦੇ ਨਾਲ ਸਾਨੂੰ ਬਹੁਤ ਤਗੜਾ ਝਟਕਾ ਲੱਗਦਾ ਹੈਗਾ ਇਸ ਕਰਕੇ ਬਿਜਲੀ ਦੇ ਉੱਤੇ ਜਿੰਨੇ ਸਾਨੂੰ ਸੁੱਖ ਆ ਸੁਖਦ ਸੁਖ ਨੇ ਨਾ ਲਏ ਬਿਜਲੀ ਦੇ ਜਿੱਦਾਂ ਸਾਨੂੰ ਉਨੀਆਂ ਸਾਨੂੰ ਨਾਲ ਨਾਲ ਪਰੇਸ਼ਾਨੀਆਂ ਵੀ ਹੈਗੀਆਂ ਇਸ ਕਰਕੇ ਸਾਨੂੰ ਬਿਜਲੀ ਦੇ ਉਹ ਇਸ ਤਰ੍ਹਾਂ ਇਹ ਨੁਕਸਾਨ ਤੋਂ ਬਚਣਾ ਚਾਹੀਦਾ